ਜਿਵੇਂ ਕਿ ਮੈਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਕ ਹੈ ਨਾ ਅਤੇ ਮੈਨੂੰ ਮਤਲਬ ਪੇਂਟਿੰਗ ਕਈ ਤਰ੍ਹਾਂ ਦੇ ਮੈਂ ਬਣਾ ਲੈਂਦੀ ਜਿੱਦਾਂ ਕਿ ਸਕੈਚ ਸਕੈਚ ਕਿੰਗ ਸਕੈਚਿੰਗ ਜ਼ਿਆਦਾ ਕਰਦੀ ਮੈਂ ਜਿੱਦਾਂ ਆਪਾਂ ਕਿ ਕੋਈ ਕੌਂਪੀਟੀਸ਼ਨ ਹੋ ਗਿਆ ਉਹ 'ਚ ਮੈਂ ਭਾਗ ਲੈਂਦੀ ਸੀ ਹੈ ਨਾ ਸਕੂਲ ਟਾਈਮ ਮਤਲਬ ਪੈ ਪ੍ਰਾਈਮਰੀ ਸਕੂਲ 'ਚ ਮੈਂ ਬਹੁਤ ਪਾਰਟੀਸਪੇਟ ਕੀਤਾ ਜਿੱਦਾਂ ਕਿ ਕੋਈ ਪੇਂਟਿੰਗ ਬਣਾਉਣੀ ਨਾਲ ਪ੍ਰਾਈਜ਼ ਮੈਂ ਜਿੱਤਣਾ ਹੈ ਨਾ ਮਤਲਬ ਕੋਈ ਦਿੱਕਤ ਨਹੀਂ ਹੋਈ ਮੈਨੂੰ ਮਤਲਬ ਬਹੁਤ ਮੇਰਾ ਸ਼ੌਕ ਸੀ ਸ਼ੁਰੂ ਤੋਂ ਬਣਾਉਣ ਦਾ ਪੇਂਟਿੰਗ ਅਤੇ ਉਹ ਤੋਂ ਬਾਅਦ ਮੈਂ ਜਦੋਂ ਕੋਲੇਜ 'ਚ ਵੀ ਜੋਇਨ ਕੀਤਾ ਕੋਲੇਜ 'ਚ ਵੀ ਮੈਂ ਜਦੋਂ ਕੋਈ ਪਾਰਟੀਸਪੇਟ ਭਗਤ ਸਿੰਘ ਦੀ ਕੋਈ ਉਹ ਹੋਵੇ ਦਿਹਾੜਾ ਹੋਵੇ ਨਾ ਅਸੀਂ ਉਹ ਪਾਰਟੀਸਪੇਟ ਕਰਦੇ ਸੀ ਅੱਗੇ ਹੋ ਹੋ ਕੇ ਹੈ ਨਾ ਪੇਂਟਿੰਗ ਭਗਤ ਸਿੰਘ ਬਣਾਉਣੀ ਉੱਥੇ ਵੀ ਮੈਂ ਪ੍ਰਾਈਜ਼ ਜਿੱਤੇ ਹੈ ਨਾ ਅਤੇ ਕਈ ਵਾਰ ਤਾਂ ਜਿੱਦਾਂ ਗਾਂਧੀ ਜੈਯੰਤੀ ਆ ਜਾਂਦੀ ਬੰਦੇ ਗਾਂਧੀ ਜੈਯੰ ਪੋਸਟਰ ਮੇਕਿੰਗ ਮੁਕਾਬਲੇ ਹੁੰਦੇ ਉੱਥੇ ਵੀ ਮੈਂ ਪਾਰਟੀਸਪੇਟ ਕੀਤੀ ਹੈ ਨਾ ਮਤਲਬ ਕਿ ਬੰਦੇ ਨੂੰ ਕਹਿਣ ਦਾ ਭਾਵ ਹੈ ਕਿ ਹਰ ਚੀਜ਼ ਸਿੱਖਣੀ ਚਾਹੀਦੀ ਮਤਲਬ ਪੇਂਟਿੰਗ ਹਰ ਚੀਜ਼ ਬੰਦੇ ਨੂੰ ਆਉਣੀ ਚਾਹੀਦੀ ਹੈ ਨਾ ਕਿ ਕੱਲ੍ਹ ਜਿੱਦਾਂ ਸ਼ੌਕ ਹੈ ਪੈਸ਼ਨ ਹੈ ਕੁਝ ਵੀ ਹੈ ਅਤੇ ਉਹਨੂੰ ਉਹ ਚੀਜ਼ ਸਿੱਖਣ ਦੀ ਲੋੜ ਹੁੰਦੀ ਹੈ ਅਤੇ ਮੈਨੂੰ ਜਿਹੜਾ ਆਹ ਗੁਣ ਹੈ ਮੇਰੇ ਰੱਬ ਮਤਲਬ ਪਹਿਲਾਂ ਦੀ ਦੇਣ ਹੈ ਨਾ ਅਤੇ ਮੈਂ ਇਹ ਕਹਿੰ ਕਹਿੰਦੀ ਕਿ ਕਹਿਣ ਦਾ ਭਾਵ ਇਹ ਹੈ ਕਿ ਵੀ ਪੇਂਟਿੰਗ ਇੱਕ ਕਲਾ ਹੈ ਨਾ ਬੰਦੇ ਦੀ ਹੈ ਨਾ ਜਿਹੜੀ ਕਿ ਸਿੱਖਣੀ ਚਾਹੀਦੀ ਹਰ ਕਿਸੇ ਨੂੰ ਕਿ ਬੰਦੇ ਨੂੰ ਆਪਣਾ ਮਤਲਬ ਕਰੀਅਰ ਬਣਾਉਣਾ ਹੈ ਜੋ ਕੁਛ ਵੀ ਹੈ ਉਹ 'ਚ ਮਤਲਬ ਪੇਂਟਿੰਗ ਦਾ ਯੋਗਦਾਨ ਹੁੰਦਾ ਹੀ ਹੁੰਦਾ ਹੈ ਹੈ ਨਾ ਅਤੇ ਕਈ ਕਈ ਬੱਚੇ ਕਲਾਸਾਂ ਲਗਾਉਂਦੇ ਹੈ ਅਤੇ ਕੁਝ ਪੇਂਟਿੰਗ ਕਲਾਸਾਂ ਜੋਇਨ ਕਰਦੇ ਕੇ ਹਨ ਸਿੱਖਣ ਯੋਗ ਹੋਰ ਇਨਕ੍ਰੀਜ਼ ਕਰੇ ਆਪਣੇ ਆਪ ਨੂੰ ਕਮੀਆਂ ਨੂੰ ਹੈ ਨਾ ਇਹਦੇ ਕਰਕੇ ਕਿ ਬ ਪੇਂਟਿੰਗ ਦਾ ਮ ਔਰ ਕ ਔਰ ਆਪਣਾ ਕਰੀਅਰ ਆ ਉਹ 'ਚ ਵਧ ਵਧੀਆ ਸਫ਼ਲ ਰਹੇ ਹੈ ਨਾ ਪਰ ਜਿਹੜਾ ਇਹ ਕਰੀਅਰ ਜਿਹੜਾ ਮੇਰਾ ਮੈਨੂੰ ਨਾ ਅੰਦਰੋਂ ਉਹਨੇ ਈਗੋ ਨੇ ਵਧਾਇਆ ਮਤਲਬ ਕਿ ਇਹ ਮੈਨੂੰ ਸਿੱਖਣ ਦੀ ਲੋੜ ਨਹੀਂ ਪਈ ਮੈਂ ਖੁਦ ਹੀ ਅੰਦਰੋਂ ਮੇਰਾ ਮਤਲਬ ਹੱਥ ਮਤਲਬ 'ਚ ਸੀਗੀ ਕਿ ਹਾਂ ਮੈਂ ਇਹ ਚੀਜ਼ ਕਰਨੀ ਮੈਂ ਪ੍ਰੋਪਰ ਤਰੀਕੇ ਨਾਲ ਕਰਦੀ ਸੀ ਮਤਲਬ ਕੋਈ ਸਿੱਖਣ ਲੋੜ ਨਹੀਂ ਪਈ ਹੈ ਨਾ ਮੈਂ ਆਖਰ 'ਚ ਇਹ ਕਹਿਣਾ ਚਾਹੁੰਦੀ ਸਭ ਨੂੰ ਆਪਣੇ ਸਿੱਖਣ ਦੀ ਲੋੜ ਪੈਂਦੀ ਹੈ ਸਿੱਖ ਸਕਦੇ ਹੈ ਨਾ ਹਾਂਜੀ ਠੀਕ ਆ ਜੀ